ਸਭ ਤੋਂ ਪਹਿਲਾਂ ਸ ਸਵੇਰੇ ਨਹਾ ਨੁਹ ਕੇ ਅਤੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਹਾਂ ਅਤੇ ਉਸ ਤੋਂ ਬਾਅਦ ਏ ਵਾਪਸ ਆ ਕੇ ਰੋਟੀ ਪਾਣੀ ਖਾ ਕੇ ਅਤੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਾਂ ਅਤੇ ਸਕੂਲ ਛੱਡ ਕੇ ਅਤੇ ਫਿਰ ਘਰ ਘਰ ਦੇ ਵਿੱਚ ਡੰਗਰ ਵੱਛਾ ਨਲ਼ਾ ਨਲ਼ਾ ਕੇ ਅਤੇ ਫਿਰ ਖੇਤਾਂ ਨੂੰ ਚਲੇ ਜਾਂਦੇ ਹਾਂ ਖੇਤਾਂ ਦੇ ਵਿੱਚ ਬਰਸੀਨ ਕੱਖ ਲਿਆ ਕੇ ਅਤੇ ਉਹਨਾਂ ਦੇ ਫਿਰ ਉਹਨਾਂ ਨੂੰ ਨਲ਼ਾ ਨਲ਼ਾਈਦਾ ਮੱਝਾਂ ਨੂੰ ਨਲ਼ਾਈਦਾ ਅਤੇ ਮੱਝਾਂ ਨੂੰ ਉਹ ਤ ਉਹ ਤੋਂ ਬਾਅਦ ਦੁਪਹਿਰ ਦੀ ਰੋਟੀ ਪਾਣੀ ਖਾਈ ਦੀ ਆ ਅਤੇ ਉਸ ਤੋਂ ਬਾਅਦ ਮਾਤਾ ਬਜ਼ੁਰਗ ਅਤੇ ਉਹਨਾਂ ਨੂੰ ਦਵਾਈ ਦਵਾਣ ਆਈ ਦੀ ਆ ਢਿੱਲੇ ਮਿੱਸੇ ਹੁੰਦੇ ਆ ਅਤੇ ਡਾਕਟਰ ਪਾਸ ਲੈ ਕੇ ਜਾਈਦਾ ਅਤੇ ਉਸ ਤੋਂ ਬਾਅਦ ਅਤੇ ਫਿਰ ਬੱਚੇ ਨੂੰ ਬੱਚਿਆਂ ਨੂੰ ਸਕੂਲ ਤੋਂ ਵਾਪਸ ਲੈ ਕੇ ਆਉਂਦਾ ਹੁੰਦਾ ਏ ਅਤੇ ਉਸ ਤੋਂ ਬ ਬਾਅਦ ਫਿਰ ਸ਼ਾਮ ਨੂੰ ਰੋਟੀ ਰਾਟੀ ਖਾ ਕੇ ਅਤੇ ਸ਼ਾਮ ਨੂੰ ਅਸੀਂ ਆਪਣਾ ਖੇਡਣ ਖੇਡਣ ਚਲੇ ਜਾਂਦੇ ਹਾਂ ਅਤੇ ਬੱਚਿਆਂ ਨੂੰ ਘੁੰਮਾ ਲਿਆਈ ਦਾ ਸੈਰ ਸੈਰ ਕਰ ਆਈ ਦਾ ਸੈਰ ਸ਼ੂਰ ਕਰਕੇ ਅਤੇ ਸ਼ਾਮ ਨੂੰ ਆਪਣਾ ਰੋਟੀ ਪਾਣੀ ਖਾ ਪੀ ਕੇ ਅਤੇ ਆਪਣਾ ਪੈੱਗ ਸ਼ੈੱਗ ਲਾ ਲੂ ਕੇ ਅਤੇ ਆਪਣਾ ਇੰਨਜੋਏ ਕਰੀ ਦਾ ਏ ਪੂਰਾ ਇੰਨਜੋਏ ਕਰ ਕੁਰ ਕੇ ਆਪਣਾ ਘੁੰਮ ਆਈ ਦਾ ਅਤੇ ਉਸ ਤੋਂ ਬਾਅਦ ਆਪਣਾ ਰੋਟੀ ਪਾਣੀ ਖਾ ਖਾ ਕੇ ਅਤੇ ਆਪਣਾ ਪੈ ਜਾਈਦਾ ਅਤੇ ਸਵੇਰੇ ਉੱਠ ਕੇ ਫਿਰ ਉਹੀ ਇਸ ਤਰ੍ਹਾਂ ਮੈਂ ਸਮਾਂ ਬਤੀਤ ਕਰਦਾ ਹਾਂ